ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਅ ਫੇਮਸ ਖਿਡਾਰੀ ਸਨ ਜਿਹਨਾਂ ਦੇ ਵਿੱਚੋਂ ਮੇਜਰ ਧਿਆਨ ਚੰਦ ਅਤੇ ਮਿਲਖਾ ਸਿੰਘ ਸਨ ਮੇਜਰ ਧਿਆਨ ਚੰਦ ਇੱਕ ਹਾਕੀ ਦੇ ਪਲੇਅਰ ਸੀ ਜਿਹਨਾਂ ਨੂੰ ਦੀ ਹਾਕੀ ਦੇ ਸਾਰੇ ਹੀ ਦੀਵਾਨੇ ਸਨ ਮੇਜਰ ਧਿਆਨ ਚੰਦ ਬਹੁਤ ਹੀ ਵਧੀਆ ਕਿਸਮ ਦੇ ਖਿਡਾਰੀ ਸਨ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਆ ਜਾਂਦੇ ਹਨ ਮਿਲਖਾ ਸਿੰਘ ਮਿਲਖਾ ਸਿੰਘ ਭੱਜਣ ਦੇ ਸ਼ੌਕੀਨ ਸਨ ਜੋ ਕਿ ਬਹੁਤ ਹੀ ਤੇਜ਼ ਭੱਜਦੇ ਸਨ ਅਤੇ ਉਹਨਾਂ ਨੇ ਇਹ ਇਸ ਖੇਡ ਦੇ ਦੌਰਾਨ ਬਹੁਤ ਹੀ ਸਾਰੇ ਮੈਡਲ ਹਾਸਲ ਕੀਤੇ ਜਿਹਨਾਂ ਵਿੱਚ ਉਨ੍ਹਾਂ ਜਿਨ੍ਹਾਂ 'ਚ ਜਿਨ੍ਹਾਂ ਕਰਕੇ ਉਹਨਾਂ ਦਾ ਨਾਮ ਬਹੁਤ ਹੀ ਮਸ਼ਹੂਰ ਹੋਇਆ ਅਤੇ ਉਹ ਇੱਕ ਛਾਪ ਛੱਡ ਗਏ